ਸਤਿ ਸ਼੍ਰੀ ਅਕਾਲ ਜੀ ਅਸੀਂ ਫੁਰਸਤ ਰੈਸਟੋਰੈਂਟ 'ਤੇ ਗੱਲ ਕਰ ਰਹੇ ਹਾਂ ਅ ਠੀਕ ਆ ਜੀ ਮੇਰਾ ਨਾਮ ਰਾਜਨਦੀਪ ਕੌਰ ਆ ਜੀ ਅਸੀਂ ਸਰਹੰਦ ਦੇ ਰਹਿਣ ਵਾਲੇ ਹਾਂ ਅਤੇ ਅਸੀਂ ਅੱਜ ਸ਼ਾਮ ਨੂੰ ਨਾ ਇੱਕ ਛੋਟੀ ਜਿਹੀ ਪਾਰਟੀ ਕਰਨੀ ਸੀ ਜਿਹਦੇ ਵਿੱਚ ਇੱਕ ਮੈਂ ਹੋਉਂਗੀ ਅਤੇ ਮੇਰੇ ਪਰਿਵਾਰ ਦੇ ਵੀਹ ਕੁ ਮੈਂਬਰ ਹੋਣਗੇ ਅਤੇ ਅਸੀਂ ਚਾਹੁੰਦੇ ਸੀ ਜਿਹੜੀ ਇਹ ਪਾਰਟੀ ਆ ਇਹ ਸ਼ਾਮ ਦੇ ਟਾਈਮ ਤੋਂ ਪੰਜ ਕੁ ਵਜੇ ਤੋਂ ਸਟਾਰਟ ਹੋ ਜਾਵੇ ਹੈ ਨਾ ਅਤੇ ਸਭ ਤੋਂ ਪਹਿਲਾਂ ਸਾਨੂੰ ਖਾਣ ਲਈ ਸਨੈਕਸ ਵਗੈਰਾ ਦਿੱਤੇ ਜਾਣ ਜਿੱਦਾਂ ਤੁਹਾਨੂੰ ਪਤਾ ਹੀ ਤੁਸੀਂ ਸਾਰਿਆਂ ਨੂੰ ਦਿੰਦੇ ਹੀ ਹੋ ਜਿਹਦੇ ਵਿੱਚ ਮੋਮੋਜ ਹੋ ਗਏ ਸਪਰਿੰਗ ਰੋਲ ਹੋ ਗਏ ਸੈਂਡਵਿਚ ਵਗੈਰਾ ਹੋ ਗਏ ਨਾਲ ਉਹਨਾਂ ਦੇ ਕੋਈ ਹੋਟ ਟੀ ਵਗੈਰਾ ਲਗਾ ਲਓ ਜਾਂ ਕੋਲ ਡਰਿੰਕ ਵਗੈਰਾ ਲਗਾ ਲਓ ਹੈ ਨਾ ਅਤੇ ਉਸ ਤੋਂ ਬਾਅਦ ਜੇ ਤੁਸੀਂ ਹੋ ਸਕਿਆ ਸਾਨੂੰ ਇੱਕ ਕੇਕ ਦਾ ਵੀ ਪ੍ਰਬੰਧ ਕਰ ਦਿਓ ਅਤੇ ਉਹਦੇ ਉੱਪਰ ਮੇਰਾ ਨਾਮ ਵਗੈਰਾ ਵੀ ਲਿਖ ਦਿਓ ਰਾਜਨਦੀਪ ਕੌਰ ਅਤੇ ਕੇਕ ਆ ਜਿਹੜਾ ਉਹ ਵਧੀਆ ਕੁਆਲਿਟੀ ਦਾ ਹੋਵੇ ਹੈ ਨਾ ਅਤੇ ਸਾਨੂੰ ਇਹ ਚੀਜ਼ ਲਈ ਸਾਨੂੰ ਮਤਲਬ ਜਿਹੜੇ ਪੇਮੈਂਟ ਆ ਉਹ ਪਹਿਲਾਂ ਐਡਵਾਂਸ ਕਰਨੀ ਪੈਣੀ ਆ ਉਹਦੀ ਜਾਂ ਅਸੀਂ ਆ ਕੇ ਹੀ ਤੁਹਾਨੂੰ ਪੇਮੈਂਟ ਜਿਹੜੀ ਕਰਕੇ ਜਾਈਏ ਅਤੇ ਇੱਦਾਂ ਕਰਿਓ ਉਸ ਤੋਂ ਬਾਅਦ ਸ਼ਾਮ ਨੂੰ ਹਨੇਰਾ ਹੋ ਜਾਣਾ ਅਤੇ ਸਾਨੂੰ ਰੋਟੀ ਦਾ ਡਿਨਰ ਦਾ ਵੀ ਪ੍ਰਬੰਧ ਕਰ ਦਿੱਤਾ ਜਾਵੇ ਉਹਦੇ ਵਿੱਚ ਇੱਕ ਦਾਲ ਮੱਖਣੀ ਕਰ ਦਿਓ ਇੱਕ ਕੋਈ ਮਿਕਸ ਸਬਜ਼ੀ ਕਰ ਦਿਓ ਅਤੇ ਰਾਇਤਾ ਵਗੈਰਾ ਕਰ ਦਿਓ ਨਾਲ ਸਲਾਦ ਕਰ ਦਿਓ ਅਤੇ ਪਲੱਸ ਫਿਫਟੀ ਕੋਚ ਪੰਜਾਹ ਕੁ ਨੇ ਜਿਹੜੀਆਂ ਉਹ ਰੋਟੀਆਂ ਕਰ ਦਿਓ ਇਹ ਸਾਰਾ ਲਈ ਧੰਨਵਾਦ